ਮੈਂ ਮੋਹਾਲੀ ਦੇ ਇੱਕ ਪਿੰਡ ਦਾ ਨਿਵਾਸੀ ਹਾਂ ਜਿੱਥੇ ਤੱਕ ਦੇਖਿਆ ਜਾਵੇ ਮੇਰਾ ਪੋਲੀਟਿਕਸ ਨਾਲ਼ ਜ਼ਿਆਦਾ ਉੱਠਣਾ ਬੈਠਣਾ ਨਹੀਂ ਹੈਗਾ ਪਰ ਪਿੰਡ ਦੇ ਸਰਪੰਚ ਨਾਲ਼ ਮੇਰੀ ਕਾਫੀ ਚੰਗੀ ਯਾਰੀ ਦੋਸਤੀ ਆ ਅਤੇ ਉਹ ਪਿੰਡ ਦਾ ਬਹੁਤ ਵਧੀਆ ਸਰਪੰਚ ਆ ਪਿੰਡ ਦੀ ਉਹਨੇ ਕਾਫੀ ਵਿਸ ਵਿਕਾਸ ਲਈ ਕੰਮ ਕੀਤੇ ਨੇ ਜਿਵੇਂ ਸਕੂਲ ਬਣਾਏ ਸੀਗੇ ਹੋਸਪਿਟਲ ਬਣਾਏ ਸੀ ਸਕੂਲ 'ਚ ਸੜਕਾਂ ਪੱਕੀਆਂ ਕਰਾਈਆਂ ਸੀਗੀਆਂ ਪਿੰਡ ਦੀ ਹੋਰ ਵੀ ਸਾਫ਼ ਸਫ਼ਾਈ ਦਾ ਵੀ ਧਿਆਨ ਰੱਖਦਾ ਹੈ